ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਰਮਨ ਦੀ ਮੰਮਾ ਬੋਲਦੀ ਹਾਂ ਹਾਂਜੀ ਹਾਂਜੀ ਅੱਛਾ ਅੱਛਾ ਨਹੀਂ ਨਹੀਂ ਮੈਮ ਕੱਲ੍ਹ ਤਾਂ ਓਕੇ ਸੀ ਕੱਲ੍ਹ ਸ਼ਾਮ ਨੂੰ ਬਿਲਕੁਲ ਠੀਕ ਠਾਕ ਖੇਡ ਰਿਹਾ ਸੀ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਮੈਂ ਤਾਂ ਸਵੇਰੇ ਪ੍ਰੋਪਰ ਬ੍ਰੇਕਫਾਸਟ ਕਰਕੇ ਉਹਨੂੰ ਭੇਜਿਆ ਮੈਮ ਹਾਂਜੀ ਹਾਂਜੀ ਅਤੇ ਹਾਂਜੀ ਠੀਕ ਠੀਕ ਹੈ ਮੈਮ ਕੋਈ ਪ੍ਰੋਬਲਮ ਵਾਲੀ ਗੱਲ ਤੇ ਨਹੀਂ ਨਾ ਇੱਦਾਂ ਠੀ ਠੀਕ ਠੀਕ ਹੈ ਮੈਮ ਤੁਸੀਂ ਇੱਦਾਂ ਕਰੋ ਕੀ ਔਟ ਪਾਸ ਬਣਾ ਦਿਓ ਅਤੇ ਮੈਂ ਥੋੜ੍ਹੀ ਟਾਈਮ 'ਚ ਇਹਦੇ ਪਾਪਾ ਨੂੰ ਲੈ ਕੇ ਸਕੂਲ ਪੁੱਜਦੀ ਹਾਂ ਮੈਮ ਠੀਕ ਹੈ ਠੀਕ ਹੈ ਓਕੇ ਓਕੇ ਓਕੇ ਓਕੇ ਮੈਮ ਓਕੇ ਮੈਮ ਥੈਂਕ ਯੂ ਓਕੇ ਓਕੇ ਥੈਂਕ ਯੂ